ਪੰਜਾਬ ਦਾ ਸੱਭਿਆਚਾਰ ਇਸਦੇ ਇਤਿਹਾਸ ਅਤੇ ਭੂਗੋਲ ਤੋਂ ਇਸ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਲੋਕ ਇੱਕ ਦੂਸਰੇ ਨੂੰ ਇੱਜ਼ਤ ਅਤੇ ਮਾਣ ਸਤਿਕਾਰ ਨਾਲ ਬੁਲਾਇਆ ਕਰਦੇ ਸਨ ਪਰ ਹੁਣ ਇਹ ਗੱਲਾਂ ਨਹੀਂ ਰਹੀਆਂ ਲੋਕਾਂ ਦੀ ਬੋਲ਼ੀ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ ਹੈ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਹੁਣ ਲੋਕਾਂ ਦੇ ਖਾਣੇ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪਿਆ ਹੈ ਪੁਰਾਣੇ ਸਮੇਂ ਦੇ ਵਿੱਚ ਲੋਕ ਘਰ ਦਾ ਖਾਣਾ ਖਾਂਦੇ ਹੁੰਦੇ ਸੀ ਅਤੇ ਘਰ ਦੀ ਸਬਜ਼ੀ ਵਗੈਰਾ ਸਭ ਬਣਾਉਂਦੇ ਹੁੰਦੇ ਸੀ ਇਸ ਟਾਈਮ ਦੇ ਵਿੱਚ ਲੋਕ ਜੰਕ ਫੂਡ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਅਤੇ ਲੋਕਾਂ ਦਾ ਪਹਿਰਾਵਾ ਵੀ ਸਹੀ ਨਹੀਂ ਰਿਹਾ ਹੈ ਪੁਰਾਣੇ ਸਮੇਂ ਦੇ ਵਿੱਚ ਔਰਤਾਂ ਘੱਗਰਾ ਪਾਉਂਦੀਆਂ ਸੀਗੀਆਂ ਸੂਟ ਸਲਵਾਰ ਪਾਉਂਦੀਆਂ ਸੀਗੀਆਂ ਪਰ ਇਸ ਸਮੇਂ ਇਸ ਦੀ ਜਗ੍ਹਾ ਜੀਨ ਟੋਪ ਨੇ ਲੈ ਲਈ ਹੈ